ਦਸ ਅਕਤੂਬਰ ਉੱਨੀ ਸੌ ਨੱਬੇ ਅਠਾਰਾਂ ਅਪ੍ਰੈਲ ਉੱਨੀ ਸੌ ਅਠਾਸੀ ਤੀਹ ਅਕਤੂਬਰ ਦੋ ਹਜ਼ਾਰ ਅਠਾਰਾਂ ਸੋਲ੍ਹਾਂ ਅਕਤੂਬਰ ਉੱਨੀ ਸੌ ਪਚਾਸੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ